ਹੈਲੋ ਹਾਂ ਦੀਦੀ ਕਿਵੇਂ ਹੋ ਹਾਂ ਠੀਕ ਹੈ ਵਧੀਆ ਤੇ ਬਸ ਮੈਂ ਤੁਹਾਡੇ ਤੋਂ ਨੰਬਰ ਕੱਲ੍ਹ ਲਿਆ ਸੀ ਅਸੀਂ ਨਵੇਂ ਹੀ ਇੱਥੋਂ ਆਏ ਵੇ ਹੈਗੇ ਸਾਨੂੰ ਹਾਂ ਅਤੇ ਸਾਨੂੰ ਇਹਨਾਂ ਵੀ ਫਰੂ ਇਹਨਾਂ ਪਤਾ ਨਹੀਂ ਵੀ ਕੀ ਕਿੱਥੇ ਕਿੱਥੇ ਕਿਸ ਹਿਸਾਬ ਨਾਲ ਕੀ ਚੀਜ਼ ਕਿੱਥੇ ਮਿਲਦੀ ਹੈ ਨਾ ਫਰੂਟ ਵਗੈਰਾ ਜੇ ਤਾਜ਼ਾ ਮਿਲ ਜਾਵੇ ਹਾਂ ਤਾਜ਼ਾ ਫਰੂਟ ਜਿਵੇਂ ਕਿਸ ਜਗ੍ਹਾ ਤੋਂ ਮਿਲਦਾ ਕਿਵੇਂ ਕਿਹੜੀ ਮੰਡੀ 'ਚੋਂ ਮਿਲਦਾ ਠੀਕ ਹੈ ਅੱਛਾ ਅੱਛਾ ਅੱਛਾ

ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਅੱਛਾ ਤੁਸੀਂ ਇੱਥੋਂ ਹੀ ਲੈ ਲੈਂਦੇ ਸੀਗੇ ਅੱਛਾ ਅੱਛਾ ਠੀਕ ਹੈ

ਹਾਂਜੀ ਹਾਂਜੀ ਤਾਂ ਆਪਾਂ ਨੂੰ ਅਗਾਂਹ ਹੁਣ ਸਰਦੀ ਆ ਰਹੀ ਹੈ ਅਤੇ ਹਜੇ ਤਾਂ ਆਪਾਂ ਨੂੰ ਇੰਨਾ ਵੀ ਇੱਥੋਂ ਦੇ ਬਾਜ਼ਾਰਾਂ ਬਾਰੇ ਵੀ ਨਹੀਂ ਪਤਾ ਤੁਹਾਨੂੰ ਜ਼ਿਆਦਾ ਇਸ ਵਾਰੇ ਬਿਹਤਰ ਪਤਾ ਹੈਗਾ ਸਾਨੂੰ ਇੰਨਾ ਕੁ ਦੱਸ ਸਕਦੇ ਹੋ ਵੀ ਤੁਸੀਂ ਆਪ ਸਾਡੇ ਨਾਲ ਜਾ ਸਕਦੇ ਹੋ ਇਸ ਦੁਕਾਨਾਂ 'ਤੇ ਹਾਂਜੀ ਠੀਕ ਹੈ ਠੀਕ ਹੈ ਹਾਂ ਸਰਦੀ ਆ ਗਈ ਨਾ ਹੁਣ ਇਸ ਕਰਕੇ ਵੀ ਆਪਾਂ ਨੂੰ ਸ਼ੋਲ ਵਗੈਰਾ ਕੋਟੀ ਵਗੈਰਾ ਇਹਨਾਂ ਦਾ ਚੀਜ਼ਾਂ ਨੂੰ ਲੈਣਾ ਪੈਣਾ ਵੀ ਆਪਾਂ ਕੋਈ ਸਮਾਨ ਤਾਂ ਲੈ ਕੇ ਨਹੀਂ ਆਏ ਬਾਹ ਬਾਹਲਾ ਵੀ ਆਪਾਂ ਨੂੰ ਇੱਥੋਂ ਹੀ ਸੈੱਟ ਕਰਨਾ ਪੈਣਾ ਆਪਣੀ

ਅੱਛਾ ਤੁਸੀਂ ਆਪਣੇ ਤੁਸੀਂ ਸਾਡੇ ਘਰ ਆਓ ਜ਼ਰੂਰ ਇੱਕ ਵਾਰ ਚਾਹ ਪਾਣੀ ਦੀ ਸੇਵਾ ਕਰਾਂਗੇ ਹਾਂਜੀ ਹਾਂਜੀ ਧੰਨਵਾਦ ਥੈਂਕ ਥੈਂਕ ਯੂ